ਪੰਜਾਬੀ ਐਮ ਸੀ ਦੁਆਰਾ ਮੁੰਡਿਆਂ ਤੋਂ ਬਚ ਕੇ ਦਲੇਰ ਮਹਿੰਦੀ ਦੁਆਰਾ ਤੁਨਕ ਤੁਨਕ ਤੁਰ ਦਿਲ ਧੜਕਣੇ ਦੋ ਦੁਆਰਾ ਗੱਲਾਂ ਗੁੱਡੀਆਂ ਮੋਰਨੀ ਬਣ ਕੇ ਤੂੰ ਬਥਈ ਹੋ ਮੰਨਤ ਨੂਰ ਦੁਆਰਾ ਲੋਗ ਲਾਚੀ ਗੁਰੂ ਰੰਧਾਵਾ ਦੁਆਰਾ ਲਾਹੌਰ ਗੁਰਦਾਸ ਮਾਨ ਦੀ ਜਿੰਦ ਮਾਹੀ ਬਾਡੀਗਾਡ ਤੋਂ ਮੇਰੀ ਤੇਰੀ ਮੇਰੀ ਦਿਲਜੀਤ ਦੋਸਾਂਝ ਦੀ ਪਟਿਆਲਾ ਪੈੱਗ ਤਨੂੰ ਬੈਡਸ ਮਨੂੰ ਸੇ ਸਦੀ ਗਲੀ ਜਿੱਥੋ ਤੱਕ ਮੇਰੇ ਮਨ ਪਸੰਦਦੀ ਮੈਨੂੰ ਲੱਗਦਾ ਹੈ ਕੀ ਮੁੰਡਿਆਂ ਤੋਂ ਬਚ ਕੇ ਮੋਰਨੀ ਬਣਕੇ ਤੋਂ ਵਧਾਈ ਹੋ ਮੰਨਤ ਨੂਰ ਦੁਆਰਾ ਲੋਂਗ ਲਾਚੀ ਜਿ ਭੰਗੜੇ ਦੇ ਫਜੂਲ ਲਈ ਪ੍ਰਤੀਕ ਹੈ ਇਸ ਨੂੰ ਦਲਜੀਤ ਦੋਸਾਂਝ ਦੀ ਪਟਿਆਲਾ ਪੈਗ ਤਨੂੰ ਬੈਡਸ ਮਨੂੰ ਸੋ ਸੱਦੀ ਗਲੀ ਜਿੱਥੇ ਤੱਕ ਮੇਰੇ ਮਨਪਸੰਦੀ ਦੀ ਗੱਲ ਹੈ ਮੈਨੂੰ ਮੁੰਡਿਆਂ ਤੋਂ ਬਚ ਕੇ